ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਸਰ ਆਪਾਂ ਨਾ ਸਾਈਕਲ ਲੈਣੀ ਹੈ ਬੱਚਿਆਂ ਵਾਸਤੇ ਆਪਾਂ ਸਰ ਛੋਟੀ ਲੈਣੀ ਹੈ ਜਿਹਦੇ ਡੰਡਾ ਨਾ ਹੋਵੇ ਉਹ ਵਾਲੀ ਸਾਈਕਲ ਲੈਣੀ ਹੈ ਹਾਂਜੀ ਹਾਂਜੀ ਬਗੈਰ ਡੰਡੇ ਵਾਲੀ ਅਤੇ ਆਪਣੇ ਕੋਲ ਕਿਹੜੀ ਕਿਹੜੀ ਕੰਪਨੀ ਦੀ ਮਿਲੇਗੀ ਠੀਕ ਹੈ ਏਟ ਪਲੱਸ ਹੈ ਸਰ ਉਹ ਕਿੰਨੇ ਪ੍ਰਾਈਜ ਤੋਂ ਸ਼ੁਰੂ ਹੁੰਦੀ ਹੈ ਚਾਰ ਹਜ਼ਾਰ ਤੋਂ ਅਤੇ ਬੱਚ ਸਰ ਮੈਨੂੰ ਦੋਨੇ ਚੀਜ਼ਾਂ ਹੀ ਚਾਹੀਦੀਆਂ ਇੱਕ ਗੇਅਰ ਵਾਲੀ ਵੀ ਚਾਹੀਦੀ ਹੈ ਅਤੇ ਇੱਕ ਬਿਨਾਂ ਗੇਅਰ ਵਾਲੀ ਵੀ ਚਾਹੀਦੀ ਹੈ ਛੋ ਛੋਟੇ ਬੱਚਿਆਂ ਵਾਸਤੇ ਚਾਹੀਦੀ ਹੈ ਅਤੇ ਠੀਕ ਹੈ ਜੀ ਕਲਰ ਸਰ ਤੁਹਾਡੇ ਕੋਲ ਕਿਹੜੇ ਕਿਹੜੇ ਅਵੇਲੇਬਲ ਹੈਗੇ

ਹਾਂਜੀ ਇਹ ਅਤੇ ਬਰਾਉਨ ਕਲਰ 'ਚ ਮਿਲ ਜਾਏਗਾ ਆਪਣਾ ਚਲੋ ਠੀਕ ਹੈ ਸਰ ਬਰਾਊਨ 'ਚ ਆਪਾਂ ਗੇਅਰ ਵਾਲੀ ਸਾਈਕਲ ਲੈਣੀ ਹੈ ਅਤੇ ਛੋਟੇ ਬੱਚੇ ਵਾਸਤੇ ਲੈਣੀ ਹੈ ਅਤੇ ਉਹਦਾ ਕਿੰਨਾ ਪ੍ਰਾਈਜ਼ ਹੋਏਗਾ ਛੋਟੇ ਬੱਚੇ ਵਾਸਤੇ ਨਹੀਂ ਆ ਉਹਦਾ ਕਿੰਨਾ ਪ੍ਰਾਈਜ਼ ਹੋਏਗਾ ਠੀਕ ਹੈ ਸਰ ਅਤੇ ਗੇਅਰ ਵਾਲੀ ਚਲੋ ਠੀਕ ਹੈ ਸਰ ਆਪਣਾ ਨਾ ਇਹ ਦੋਵੇਂ ਆਰਡਰ ਬੁੱਕ ਕਰ ਲਿਓ ਦੋਨੇ ਅਤੇ ਇੱਕ ਸਰ ਮੇਰੇ ਵਾਸਤੇ ਚਾਹੀਦੀ ਹੈ ਸਾਈਕਲ ਵੱਡੀ ਸਾਈਕਲ ਹਾਂਜੀ ਹਾਂਜੀ ਉਹ ਮੈਨੂੰ ਚਾਹੀਦੀ ਹੈ ਸਰ ਹੀਰੋ ਕੰਪਨੀ ਦੀ ਚਾਹੀਦੀ ਹੈ ਰੈਂਜਰ ਰੈਂਜਰ ਸਰ ਹਾਂਜੀ ਹਾਂਜੀ ਹਾਂ ਹਾਂ ਗੇਅਰ ਵਾਲੀ ਚਾਹੀਦੀ ਹੈ ਸਰ

ਅਤੇ ਇ ਇਹਦੇ 'ਚ ਆਪਾਂ ਨੂੰ ਵੱਡਿਆਂ ਦਾ ਜਿਵੇਂ ਹੁੰਦਾ ਉਹਦੇ 'ਚ ਕਿੰਨੇ ਮਤਲਬ ਸਟਾਰਟਿੰਗ ਹੋਏਗੀ ਪ੍ਰਾਈਜ ਕਿੰਨੇ ਸਟਾਰਟਿੰਗ ਹੋਏਗੀ ਛੇ ਹਜ਼ਾਰ ਤੋਂ ਅਤੇ ਡਿਸਕਾਊਂਟ ਕੋਈ ਮਿਲੇਗਾ ਚਲੋ ਠੀਕ ਹੈ ਸਰ ਫਿਰ ਤਾਂ ਬਹੁਤ ਵਧੀਆ ਜੇ ਇੰਚੀ ਸਰ ਇੰਚੀ ਬਾਰੇ ਮੈਨੂੰ ਨੋਲੇਜ ਹੈ ਨਹੀਂ ਗਈ ਆਪਾਂ ਨੂੰ ਮੀਡੀਅਮ ਸਾਈਜ਼ ਹੀ ਚਾਹੀਦਾ ਬਾਈ ਇੰਚੀ ਮਿਲ ਜਾਏ ਆਪਾਂ ਨੂੰ ਹਾਂ ਅਤੇ ਆਪਾਂ ਨੂੰ ਅਤੇ ਕਲਰ ਆਪਾਂ ਨੂੰ ਬਲੈਕ ਚਾਹੀਦਾ ਸਰ ਬਲੈਕ ਮਿਲ ਜਾਏਗਾ ਨਾ ਚਲੋ ਬਹੁਤ ਵਧੀਆ ਅਤੇ ਏ ਸਰ ਮੈਂ ਆ ਜਾਂਦਾ ਤੁਹਾਡੇ ਸ਼ੋਪ 'ਤੇ ਦੇਖ ਲੈਂਦੇ ਹਾਂ ਠੀਕ ਹੈ ਸਰ ਓਕੇ ਓਕੇ ਸਰ